ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਬੱਚਿਆਂ ਨੂੰ ਅਤੇ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਪਠਾਨਕੋਟ ਵਿੱਚ ਗਈ ਸੀ ਜਿਸ ਤਰ੍ਹਾਂ ਕਿ ਪਠਾਨਕੋਟ ਪਹਾੜੀ ਵਿੱਚ ਇੱਕ ਮੰਦਰ ਹੈ ਮਾਤਾ ਦਾ ਮੰਦਰ ਜਿਸ ਤਰ੍ਹਾਂ ਦੁਰਗਾ ਮਾਤਾ ਦਾ ਮੰਦਰ ਔਰ ਉੱਥੇ ਸੁਜਾਨਪੁਰ ਵਿੱਚ ਬਾਗ ਵਾਲੀ ਮਾਤਾ ਦਾ ਮੰਦਰ ਮੈਂ ਉੱਥੇ ਆਪਣੇ ਬੱਚਿਆਂ ਨੂੰ ਘੁੰਮਾਉਣ ਵਾਸਤੇ ਗਈ ਸੀ ਔਰ ਅੰਮ੍ਰਿਤਸਰ ਵੀ ਗਈ ਸੀ ਅੰਮ੍ਰਿਤਸਰ ਵਿੱਚ ਮੈਂ ਜਲਿਆਂਵਾਲਾ ਬਾਗ਼ ਦੇਖਿਆ ਔਰ ਉੱਥੇ ਜਾ ਕੇ ਗੋਲਡਨ ਟੈਂਪਲ ਜੋ ਕਿ ਬਹੁਤ ਅੱਛਾ ਹੈ ਸਭ ਕੁਛ ਦੇਖਿਆ ਗੱਲ ਕੀਤੀ ਜਾਵੇ ਤਾਂ ਸਾਡੇ ਇੱਧਰ ਪੰਜਾਬ ਵਿੱਚ ਬਹੁਤ ਸਾਰੀਆਂ ਘੁੰਮਣ ਵਾਲੀਆਂ ਜਗ੍ਹਾ ਹੈ ਜਿਸ ਤਰ੍ਹਾਂ ਜੁਗਿਆਲ ਵਿੱਚ ਮਿੰਨੀ ਗੋਆ ਮੁਕੇਤਸਰਾਂ ਪਰੀਆਂ ਦਾ ਬਾਗ ਸਭ ਹਰ ਜਗ੍ਹਾ ਵਿੱਚ ਜਾ ਕੇ ਮੈਂ ਆਪਣੇ ਬੱਚਿਆਂ ਨੂੰ ਘੁੰਮਾ ਕੇ ਲਿਆਈ ਬਹੁਤ ਜ਼ਿਆਦਾ ਅਨੰਦ ਮਿਲਿਆ ਮੇਰੇ ਬੱਚਿਆਂ ਨੂੰ ਮੇਰੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਗੋਲਡਨ ਟੈਂਪਲ ਪਸੰਦ ਆਇਆ ਪਠਾਨਕੋਟ ਵਿੱਚ ਘੁੰਮਣ ਦਾ ਸਭ ਤੋਂ ਜ਼ਿਆਦਾ ਨਜ਼ਾਰਾ ਲਿਆ ਜਿਸ ਤਰ੍ਹਾਂ ਕਿ ਘੁੰਮਣ ਵਾਸਤੇ ਉੱਥੇ ਬਹੁਤ ਸਾਰੇ ਮੰਦਰ ਬਣੇ ਹੋਏ ਹੈ ਗੁਰਦੁਆਰੇ ਬਣੇ ਹੋਏ ਹੈ ਮੈਂ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਘੁੰਮਾ ਕੇ ਲਿਆਈ ਅਸੀਂ ਉੱਥੇ ਖਾਣ ਪੀਣ ਵਾਸਤੇ ਸਭ ਕੁਛ ਜਿਸ ਤਰ੍ਹਾਂ ਕਿ ਖਾਣ ਪੀਣ ਵਾਸਤੇ ਹੋਟਲ ਵੀ ਬਹੁਤ ਜ਼ਿਆਦਾ ਬਣੇ ਹੋਏ ਨੇ ਘੁੰਮਣ ਵਾਸਤੇ ਬਹੁਤ ਅੱਛੀ ਤੋਂ ਅੱਛੀ ਜਗ੍ਹਾ ਬਣੀ ਹੋਈ ਸਾਡੇ ਪਠਾਨਕੋਟ ਵਿੱਚ ਔਰ ਸਤਿ ਸ਼੍ਰੀ ਅਕਾਲ ਸਰ ਥੈਂਕ ਊ